ਇਹ ਜਿਹੜੀ ਕਸਰਤ ਹੈ ਦੌੜ ਭੱਜਦੇ ਹਾਂ ਸਰੀਰ ਵਾਸਤੇ ਇਹ ਬਹੁਤ ਚੰਗੀ ਹੈ ਜਿਵੇਂ ਕਿ ਸਰੀਰ ਨੂੰ ਮਜ਼ਬੂਤ ਰੱਖਣ ਵਾਸਤੇ ਦੌੜ ਲਾਉਣੀ ਬਹੁਤ ਜ਼ਰੂਰੀ ਹੈ ਅਤੇ ਜਿਵੇਂ ਆਪਣੀਆਂ ਮਸਲ ਬਣਦੇ ਨੇ ਇਹਦੇ ਨਾਲ ਭੱਜਣ ਦੇ ਨਾਲ ਆਪਣਾ ਸਰੀਰ ਫਿਟ ਰਹਿੰਦਾ ਹੈ ਜਿਵੇਂ ਕਿ ਆਪਾਂ ਨੂੰ ਭੱਜਣ ਤੋਂ ਪਹਿਲਾਂ ਇੱਕ ਘੰ ਚੰਗੀ ਤਰ੍ਹਾਂ ਪਾਣੀ ਰੱਜ ਕੇ ਪੀ ਲੈਣਾ ਚਾਹੀਦਾ ਹੈ ਅਤੇ ਨਾਲ ਭੱਜਣ ਸਮੇਂ ਆਪਾਂ ਨੂੰ ਪਾਣੀ ਦੀ ਬੋਤਲ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਆਪਣਾ ਮੂੰਹ ਸੁੱਕਦਾ ਹੈ ਤਾਂ ਆਪਾਂ ਪਾਣੀ ਪੀ ਸਕਦੇ ਹਾਂ ਅਤੇ ਪੂਰਾ ਪਾਣੀ ਨਾ ਪੀਵੇ ਇਸ ਕਰਕੇ ਜਿਵੇਂ ਕਿ ਆਪਾਂ ਭੱਜਦੇ ਭੱਜਦੇ ਜ਼ਿਆਦਾ ਪਾਣੀ ਪੀ ਲਿਆ ਅਤੇ ਆਪਣਾ ਢਿੱਡ ਦੁਖਣ ਦੀ ਪ੍ਰੋਬਲਮ ਵੀ ਆ ਜਾਂਦੀ ਹੈ ਅਤੇ ਆਪਾਂ ਨੂੰ ਭਾਜ ਲਾਉਣ ਦੇ ਨਾਲ ਆਪਣੀ ਜਿਹੜੀ ਪਾਚਨ ਪ੍ਰਣਾਲੀ ਉਹ ਵੀ ਅੱਛੀ ਹੋ ਜਾਂਦੀ ਹੈ ਅਤੇ ਇਹਦੇ ਵਿੱਚ ਭੱਜਣ ਦੇ ਨਾਲ ਬਹੁਤ ਗੱਲਾਂ ਨੇ ਜਿਵੇਂ ਕਿ ਆਪਾਂ ਨੂੰ ਭੱਜਣ ਦੇ ਨਾਲ ਆਪਣੇ ਸਰੀਰ ਨੂੰ ਪੂਰੇ ਐਨ ਫਿਟ ਰਹਿੰਦਾ ਹੈ ਫਿਟਨੈਸ ਸਰੀਰ ਦੇ ਵਿੱਚ ਰਹਿੰਦੀ ਹੈ ਅਤੇ ਦ ਆਪਣਾ ਜਿਵੇਂ ਸ ਕੋਈ ਬਿਮਾਰੀ ਨਹੀਂ ਲੱਗਦੀ ਜਿਵੇਂ ਆਪਾਂ ਦੌੜ ਲਾਉਂਦੇ ਹਾਂ ਤਾਂ ਕੋਈ ਬਿਮਾਰੀ ਨਹੀਂ ਲੱਗਦੀ ਅਤੇ ਹੋਰ ਆਪਣੇ ਵਾਸਤੇ ਸਰੀਰ ਪੱਖੋਂ ਫਿਟ ਰਹਿੰਦਾ ਹੈ